ਹਾਂਜੀ ਸਾਡੇ ਕੋਲ ਹਰ ਇੱਕ ਵਿਲੱਖਣ ਪ੍ਰਕਾਰ ਦੇ ਚੁਣੌਤੀ ਯਾਤਰੀ ਰੂੁਪ ਦੇ ਰੂਪਸ ਰੂਮ ਸਨ ਜਿਵੇਂ ਕਿ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੇ ਰੂਮਸ ਹਨ ਇੱਕ ਤਾਂ ਸਾਡੇ ਕੋਲ ਪਹਿਲੇ ਨੰਬਰ 'ਤੇ ਆ ਜਾਂਦੇ ਸਨ ਏ ਸੀ ਰੂਮ ਜਿਹਦੇ ਵਿੱਚ ਇੱਕ ਏ ਸੀ ਹੈ ਬੈੱਡ ਹੈ ਸੋਫਾ ਸੈੱਟ ਹੈ ਬਾਥਰੂਮ ਅਟੈਚ ਹੈ ਅਤੇ ਕਿਚਨ ਸੈੱਟ ਹੈ ਜਿਹਦੇ ਵਿੱਚ ਵਿੱਚ ਹੀ ਸਾਰਾ ਕੁਛ ਗੈਂਸ ਰੱਖਿਆ ਹੋਇਆ ਹੈ ਜਿਹਦਾ ਕਿ ਰੈਂਟ ਬਹੁਤ ਜ਼ਿਆਦਾ ਹੈ ਥੋੜ੍ਹਾ ਕਿ ਬਹੁਤ ਜ਼ਿਆਦਾ ਵੀ ਜਿਵੇਂ ਕਿ ਪੈਂਤੀ ਸੌ ਤੋਂ ਸਟਾਰਟ ਹੋ ਕੇ ਇਸ ਤੋਂ ਵੱਧ ਹੈ ਅਤੇ ਬਾਕੀ ਸਾਡੇ ਕੋਲ ਹਰ ਇੱਕ ਪ੍ਰਕਾਰ ਦਾ ਰੂਮ ਹੈ ਜਿਵੇਂ ਕਿ ਗਰੀਬ ਯਾਤਰੀ ਵਾਸਤੇ ਵੀ ਸਾਡੇ ਕੋਲ ਪੱਖੇ ਵਾਲੇ ਕਮਰੇ ਵੀ ਹੈਗੇ ਹਨ ਜਿਹਦੇ ਵਿੱਚ ਬੈੱਡ ਦਿੱਤਾ ਜਾਂਦਾ ਹੈ ਇੱਕ ਇੱਕ ਗੈਂਸ ਹੈ ਅਤੇ ਟੀ ਵੀ ਹੈ ਅਤੇ ਮਤਲਬ ਬਾਥਰੂਮ ਬਾਥਰੂਮ ਲੈਟਰਿੰਗ ਸਾਰਾ ਕੁਛ ਨਾਲ ਹੀ ਅਟੈਚ ਹੈਗਾ ਜਿਹਦੇ ਵਿੱਚ ਇਹ ਇਹ ਗਰੀਬ ਯਾਤਰੀ ਵਾਸਤੇ ਹੈ ਇਹਦੇ ਵਿੱਚ ਸਾਡੇ ਕੋਲ ਪੱਖੇ ਵਾਲੇ ਰੂਮਸ ਹਨ ਜਿਹਦੇ ਕਿ ਇੱਕ ਇਹਦਾ ਰੈਂਟ ਜਿਹੜਾ ਹੈ ਉਹ ਘੱਟ ਹੈਗਾ ਇੱਕ ਹੈਗਾ ਕਿ ਜਿਹੜੇ ਕਿ ਮਤਲਬ ਜੈਂਟਸ ਯਾਤਰੀ ਵਾਸਤੇ ਜਿਹੜੇ ਕਿ ਜਿਸ ਤਰ੍ਹਾਂ ਆਪਣੇ ਖਾਣੇ ਦਾ ਪ੍ਰਬੰਧ ਬਾਹਰੋਂ ਕਰਦੇ ਹਨ ਅਤੇ ਬਸ ਉਹਨਾਂ ਨੂੰ ਇੱਕ ਸੌਣ ਬਹਿਣ ਵਾਸਤੇ ਰੂਮ ਹੀ ਚਾਹੀਦਾ ਉਹ ਵੀ ਸਾਡੇ ਕੋਲ ਹੈਗਾ ਉਹਦਾ ਰੈਂਟ ਬਹੁਤ ਹੀ ਘੱਟ ਹੈ ਉਹਦੇ ਵਿੱਚ ਇੱਕ ਪੱਖਾ ਲੱਗਿਆ ਹੁੰਦਾ ਹੈ ਉਹਦੇ ਵਿੱਚ ਇੱਕ ਬੈੱਡ ਹੁੰਦਾ ਹੈ ਸਿੰਗਲ ਬੈੱਡ ਹੁੰਦਾ ਹੈ ਬਾਥਰੂਮ ਹੁੰਦਾ ਲੈਟਰਿੰਗ ਹੁੰਦੀ ਅਟੈਚ ਹੁੰਦਾ ਉਹਦੇ ਵਿੱਚ ਇੱਕ ਜੈਂਟਸ ਵਾਸਤੇ ਜੈਂਟਸ ਵਾਸਤੇ ਹੁੰਦਾ ਹੈ ਜੈਂਟਸ ਯਾਤਰੀ ਵਾਸਤੇ ਰੂਮ ਹੁੰਦਾ ਹੈ ਉਹ ਤੁਸੀਂ ਰੂਮ ਉਹ ਵਾਲੇ ਸਾਡੇ ਕੋਲ ਵੀ ਰੂਮ ਅਵੇਲੇਬਲ ਹੈਗਾ ਏ ਇੱਕ ਹੁੰਦਾ ਹੈ ਕਿ ਜਿਹਦੇ ਵਿੱਚ ਜੁਆਇੰਟ ਬੋਆਇਜ਼ ਹੁੰਦੇ ਹੈ ਜਿਵੇਂ ਕਿ ਬੋਆਇਜ਼ ਘੁੰਮਣ ਵਾਸਤੇ ਆਉਂਦੇ ਸਨ ਬੋਆਇਜ਼ ਜੁਆਇੰਟ ਰੂਮ ਵਿੱਚ ਰਹਿੰਦੇ ਸਨ ਇੱਕ ਜਗ੍ਹਾ ਵਿੱਚ ਚਾਰ ਚਾਰ ਪੰਜ ਪੰਜ ਰੂਮ ਰਹਿੰਦੇ ਸਨ ਉਹ ਵੀ ਸਾਡੇ ਕੋਲ ਲੰਮੇ ਵੱਡੇ ਰੂਮ ਹੈਗੇ ਸਨ ਏ ਸੀ ਰੂਮ ਸਾਨੂੰ ਇਹਦੇ ਵਿੱਚ ਚਾਰ ਪੰਜ ਬੈੱਡ ਲੱਗੇ ਹੁੰਦੇ ਸਨ ਇੱਕ ਬਾਥਰੂਮ ਅਟੈਚ ਹੁੰਦਾ ਹੈ ਉਹਦੇ ਵਿੱਚ ਇਹੋ ਜਿਹੇ ਸਾਡੇ ਕੋਲ ਚਾਰ ਪੰਜ ਪ੍ਰਕਾਰ ਦੇ ਸਾਡੇ ਕੋਲ ਰੂਮ ਅਵੇਲੇਬਲ ਹੁੰਦੇ ਸਨ ਅਸੀਂ ਹਰ ਇੱਕ ਪ੍ਰਕਾਰ ਦੇ ਜਾਤੀ ਕੋ ਜਾਤੀ ਵਾਸਤੇ ਮਤਲਬ ਯਾਤਰੀ ਵਾਸਤੇ ਰੂਮ ਰੱਖਦੇ ਹਾਂ